ਅੱਜ ਕੱਲ੍ਹ ਬੈਂਕਿੰਗ ਅਤੇ ਬੀਮਾ ਦੀ ਸੇਵਾਵਾਂ ਸਾਨੂੰ ਆਨਲਾਈਨ ਦੇ ਜ਼ਮਾਨੇ ਵਿੱਚ ਬਹੁਤ ਹੀ ਆਸਾਨੀ ਨਾਲ ਮਿਲ ਜਾਂਦੀਆਂ ਹਨ ਇਸ ਕਰਕੇ ਸਾਨੂੰ ਬਹੁਤ ਸਾਰੀਆਂ ਸਹੂਲਤਾਂ ਵੀ ਮਿਲ ਗਈਆਂ ਹਨ ਜਿਵੇਂ ਕਿ ਓਨਲਾਈਨ ਬੈਂਕਾਂ ਵਿੱਚੋਂ ਬਿਨਾਂ ਜਾਏ ਪੈਸੇ ਕਢਾ ਲੈਂਦੇ ਹਨ ਅਤੇ ਬਿਨਾਂ ਬੈਂਕਿੰਗ ਇਨਸ਼ੋਰੈਂਸ ਦੇ ਸੈਕਟਰਾਂ ਵਿੱਚੋਂ ਜਾ ਕੇ ਅਸੀਂ ਆਪਣੀ ਸਿਹਤ ਦੀ ਪੋਲਿਸੀ ਲੈ ਲੈਂਦ ਲੈ ਲੈਂਦੇ ਹਨ ਪਰ ਅੱਜ ਦੇ ਵਧਦੇ ਓਨਲਾਈਨ ਜਮਾਨੇ ਵਿੱਚ ਓਨਲਾਈਨ ਫਰੋਡ ਵੀ ਬਹੁਤ ਵੱਧ ਰਿਹਾ ਹੈ ਅੱਜ ਕੱਲ੍ਹ ਬੈਕਿੰਗ ਅਤੇ ਬੀਮਾ ਦੇ ਵਿੱਚ ਬਹੁਤ ਸਾਰੀਆਂ ਫਰੋਡ ਕੋਲਸ ਵੀ ਆਉਂਦੀਆਂ ਹਨ ਅਤੇ ਬਹੁਤ ਸਾਰੇ ਲਿੰਕ ਵੀ ਭੇਜੇ ਜਾਂਦੇ ਹਨ ਜਿਹਨਾਂ ਵਿੱਚ ਅਨਪੜ੍ਹ ਬੰਦਾ ਉਹਨਾਂ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਮੈਂ ਆਪਣੇ ਬੈਂਕਿੰਗ ਅਤੇ ਇਨਸ਼ੋਰੈਂਸ ਦੀ ਭਵਿੱਖ ਵਿੱਚ ਇਹ ਕਲਪਨਾ ਕਰਦਾ ਹਾਂ ਕਿ ਉਹ ਇਹਨਾ ਫਰੋਡਾਂ ਨੂੰ ਬਹੁਤ ਹੀ ਕੰਮ ਕਰਨ ਅਤੇ ਉਹਦੇ ਨਾਲ ਨਾਲ ਸਾਡੇ ਡਾਟਾ ਜੋ ਵੀ ਬੈਂਕ ਦੇ ਵਿੱਚ ਹਨ ਉਹਨਾਂ ਨੂੰ ਸਿਕਿਉਰਟੀ ਅਤੇ ਪ੍ਰਾਈਵੇਸੀ ਵਿੱਚ ਰੱਖਿਆ ਜਾਣ ਅਤੇ ਕੋਈ ਵੀ ਬੰਦਾ ਲੋਨ ਲੈਂਦਾ ਹੈ ਤਾਂ ਉਨਾਂ ਦਾ ਫੇਸ ਟੂ ਫੇਸ ਲੋਨ ਹੋਣ ਨਾ ਕਿ ਓਨਲਾਈਨ ਓਨਲਾਈਨ ਦੇ ਲੋਨ ਦੇ ਵਿੱਚ ਮਨੁੱਖ ਬੰਦਾ ਠੱਗਿਆ ਜਾਂਦਾ ਹੈ ਉਹਨਾਂ ਤੋਂ ਬਹੁਤ ਹੀ ਜ਼ਿਆਦਾ ਵਿਆਜ ਲੈ ਲਿਆ ਜਾਂਦਾ ਹੈ ਧੰਨਵਾਦ